ਅ ਥਰ ਸਾਡੇ ਜਿਹੜੇ ਪਸੰਦੀਦਾ ਗੀਤ ਨੇ ਉਹ ਪੰਜਾਬੀ ਸੌਂਗ ਨੇ ਅਤੇ ਇਹਨਾਂ ਦੇ ਵਿੱਚ ਜਿਵੇਂ ਕਿ ਕੁਝ ਆਰਟਿਸਟ ਨੇ ਜਿਵੇਂ ਕਿ ਫਿਰੋਜ਼ ਖਾਨ ਹੋ ਗਿਆ ਅ ਜੀ ਖਾਨ ਹੋ ਗਿਆ ਐਂਡ ਅ ਮਤਲਬ ਫਿਰੋਜ਼ ਖਾਨ ਜੀ ਖਾਨ ਹੋ ਗਿਆ ਸਰਤਾਜ ਹੋ ਗਿਆ ਅ ਹੋਰ ਵੀ ਇੱਧਰ ਮਤਲਬ ਕਿ ਜਿਹੜੇ ਅੱਛੇ ਸੰਗੀਤਕਾਰ ਨੇ ਕਲਾਕਾਰ ਨੇ ਸਿੰਗਰ ਨੇ ਉਹਨਾਂ ਦੇ ਸੰਗੀ ਗੀਤ ਅਸੀਂ ਸੁਣਨਾ ਪਸੰਦ ਕਰਦੇ ਹਾਂ ਅਤੇ ਜਿੱਦਾਂ ਕਿ ਸਰਤਾਜ ਦਾ ਗੀਤ ਰੁਤਬਾ ਇਹ ਇੱਕ ਬਹੁਤ ਮਤਲਬ ਕਿ ਅ ਇੱਕ ਪੀਸਫੁਲ ਸੌਂਗ ਹੈ ਜਿਸ ਨੂੰ ਸੁਣ ਕੇ ਸਾਨੂੰ ਮਤਲਬ ਦਿਲ ਨੂੰ ਸਕੂਨ ਮਿਲਦਾ ਹੈ ਅਤੇ ਸਾਨੂੰ ਬਹੁਤ ਅੱਛਾ ਲੱਗਦਾ ਹੈ ਅਕਸਰ ਹੀ ਜਦੋਂ ਮੈਂ ਕਿਸੇ ਬੱਸ ਵਿੱਚ ਸਫ਼ਰ ਕਰਦਾ ਹੁੰਦਾ ਹਾਂ ਤਾਂ ਮੈਂ ਇਹ ਸੌਂਗ ਜ਼ਿਆਦਾ ਸੁਣਦਾ ਹੈ ਅਤੇ ਦੂਸਰਾ ਜਿੱਦਾਂ ਕਿ ਮੈਂ ਜੀ ਖਾਨ ਫਿਰੋਜ਼ ਖਾਨ ਜੀ ਦਾ ਨਾਮ ਲਿਆ ਫਿਰੋਜ਼ ਖਾਨ ਜੀ ਦਾ ਸੌਂਗ ਹੈ ਜ਼ਮਾਨਾ ਜ਼ਮਾਨਾ ਸੌਂਗ ਵੀ ਬਹੁਤ ਅੱਛਾ ਲੱਗਦਾ ਹੈ ਜਦੋਂ ਕਿਤੇ ਅਸੀਂ ਘਰ ਮਤਲਬ ਕਿ ਕੋਈ ਕੰਮ ਕਰ ਰਹੇ ਹੁੰਦੇ ਹਾਂ ਤਾਂ ਉਦੋਂ ਅਸੀਂ ਫੋਨ 'ਤੇ ਲਾ ਕੇ ਇਸ ਨੂੰ ਬਹੁਤ ਜ਼ਿਆਦਾ ਸੁਣਦੇ ਹਾਂ ਇਸ ਸੌਂਗ ਨੂੰ ਮੈਂ ਵਾਰ ਵਾਰ ਇਸ ਸੌਂਗ ਨੂੰ ਸੁਣਦਾ ਇਹ ਮੇਰਾ ਬਹੁਤ ਮਤਲਬ ਕਿ ਫੇਵਰੇਟ ਸੌਂਗ ਹੈ ਇਸ ਵਿੱਚ ਬਹੁਤ ਪਿਆਰਾ ਫੀਲ ਹੈ ਔਰ ਦੂਸਰਾ ਸੌਂ ਇਕ ਤੀਸਰਾ ਸੌਂਗ ਇੱਕ ਇਹ ਗੁਰਦਾਸ ਮਾਨ ਸਾਹਿਬ ਜੀ ਦਾ ਜੇ ਜਿਹੜਾ ਕਿ ਅ ਵੇ ਕਬੂਤਰਾਂ ਵੇ ਕਾਸਦਾ ਤੈਨੂੰ ਸੱਚੇ ਰੱਬ ਦਾ ਵਾਸਤਾ ਇਹ ਸੌਂਗ ਮੈਨੂੰ ਉਦੋਂ ਅੱਛਾ ਲੱਗਦਾ ਜਦੋਂ ਮੈਂ ਕਿਤੇ ਟਰੈਵਲ ਕਰ ਰਿਹਾ ਹੁੰਦਾ ਹਾਂ ਗੱਡੀ ਦੇ ਵਿੱਚ ਜਾਂਦੇ ਹਾਂ ਤਾਂ ਅਸੀਂ ਉਦੋਂ ਲਗਾਉਂਦੇ ਹਾਂ ਐਂਡ ਹੋਰ ਵੀ ਆਰਟਿਸਟ ਜਿੱਦਾਂ ਕਿ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਦੇ ਜਿਹੜੇ ਕਿ ਥੋੜ੍ਹੇ ਜਿਹੇ ਦਲੇਰੀ ਨਾਲ ਭਰੇ ਸੌਂਗ ਅ ਜ ਜਦੋਂ ਅਸੀਂ ਬਹੁਤ ਜ਼ਿਆਦਾ ਥੱਕੇ ਹੁੰਦੇ ਹਾਂ ਥਕਾਵਟ ਮਹਿਸੂਸ ਕਰਦੇ ਹਾਂ ਤਾਂ ਅਸੀਂ ਉਹ ਸੌਂਗ ਸਿੱਧੂ ਮੂਸੇਵਾਲਾ ਜੀ ਦੇ ਸੁਣਦੇ ਹਾਂ ਐਂਡ ਉਹ ਦਲੇਰੀ ਭਰੇ ਸੌਂਗ ਸੁਣ ਕੇ ਫਿਰ ਸਾਡੇ ਵਿੱਚ ਇੱਕ ਪੋਜੀਟਿਵਿਟੀ ਜਿਹੀ ਆਉਂਦੀ ਹੈ ਇੱਕ ਹੌਸਲਾ ਜਿਹਾ ਮਿਲਦਾ ਇੱਕ ਹੌਸਲਾ ਵੱਧਦਾ ਸਾਡਾ ਬੜਾਵਾ ਮਿਲਦਾ ਸਾਨੂੰ ਅਤੇ ਇਸ ਕਰਕੇ ਅਸੀਂ ਸਿੱਧੂ ਮੂਸੇਵਾਲਾ ਜੀ ਦਾ ਇਹ ਸੌਂਗ ਅ ਜਿੱਦਾਂ ਕਿ ਅ ਮਾਲਵਾ ਮਾਲਵਾ ਬੈਲਟ ਸੌਂਗ ਹੋ ਗਿਆ ਉਹਨਾਂ ਦਾ ਹਥਿਆਰ ਸੌਂਗ ਹੋ ਗਿਆ ਇੱਦਾਂ ਦੇ ਸੌਂਗ ਮਤਲਬ ਕਿ ਅਸੀਂ ਸੁਣਦੇ ਹਾਂ